ਬਾਗਬਾਨੀ ਸ਼ੁਰੂ ਕਰਨ ਲਈ ਤੁਹਾਨੂੰ ਕੁਝ ਮ ਮੁੱਖ ਕਦਮਾਂ ਦੀ ਪਾਲਨਾ ਕਰਨੀ ਪਵੇਗੀ ਮਿੱਟੀ ਦੀ ਜਾਂਚ ਪਹਿਲਾਂ ਮਿੱਟੀ ਦੀ ਜਾਂਚ ਕਰਾਉਣਾ ਤਾਂ ਜੋ ਤੁਸੀਂ ਜਾਣ ਸਕੋ ਕਿ ਮਿੱਟੀ ਵਿੱਚ ਕਿਹੜੇ ਪੋਸ਼ਕ ਤੱਤ ਹਨ ਅਤੇ ਕਿਹੜੇ ਨਹੀਂ ਇਸ ਨਾਲ ਤੁਹਾਨੂੰ ਸਮਝ ਆਵੇਗੀ ਕਿਹੜੇ ਪੌਦੇ ਥਾਵਾਂ ਫਸਲਾਂ ਉਗਾਈਆਂ ਜਾ ਸਕਦੀਆਂ ਹਨ ਮਿੱਟੀ ਦੀ ਤਿਆਰੀ ਮਿੱਟੀ ਨੂੰ ਖਿੱਚੋ ਵਾਢੋ ਅਤੇ ਕੋਈ ਵੀ ਜੰਗਲੀ ਬੂਟੀਆਂ ਜਾਂ ਘਾਹ ਕੱਢੋ ਇਸ ਨਾਲ ਮਿੱਟੀ ਚੰਗੀ ਤਰ੍ਹਾਂ ਤਿਆਰ ਹੋ ਜਾਏਗੀ ਖਾਦ ਦੀ ਵਰਤੋਂ ਜਦੋਂ ਮਿੱਟੀ ਦੀ ਜਾਂਚ ਦੇ ਨਤੀਜੇ ਮਿਲ ਜਾਣ ਤਾਂ ਜ਼ਰੂਰੀ ਖਾਦਾਂ ਦਾ ਇੰਤਜ਼ਾਮ ਕਰੋ ਔਰਗੈਨਿਕ ਖਾਦ ਵਰਤਣਾ ਬਿਹਤਰ ਰਹੇਗਾ ਬੀਜ ਜਾਂ ਪੌਦੇ ਉਹ ਬੀਜੋ ਬੀਜ ਜਾਂ ਪੌਦੇ ਚੁਣੋ ਜੋ ਤੁਹਾਡੇ ਖੇਤਰ ਦੇ ਮੌਸਮ ਨਾਲ ਅਨੁਕੂਲ ਹੋਣ ਪਾਣੀ ਦੇ ਪ੍ਰਬੰਧ ਬਾਗ ਵਿੱਚ ਪਾਣੀ ਦੇ ਪ੍ਰਬੰਧ ਦਾ ਧਿਆਨ ਰੱਖੋ ਪਾਣੀ ਦੀ ਸੂਚਿਤ ਤਰੀਕੇ ਵਰਤੋਂ ਜਿਵੇਂ ਕਿ ਜੇ ਸਿੰਚਾਈ ਤਾਂ ਜੋ ਪਾਣੀ ਦੀ ਬਰਬਾਦੀ ਨਾ ਹੋਵੇ ਰੋਗਾਂ ਅਤੇ ਕੀੜਿਆਂ ਤੋਂ ਸੁਰੱਖਿਆ ਆਪਣੇ ਬਾਗ ਦੀ ਨਿਗਰਾਨੀ ਕਰਦੇ ਰਹੋ ਅਤੇ ਰੋਗਾਂ ਅਤੇ ਕੀੜਿਆਂ ਦੇ ਨਿਯੰਤਰਣ ਲਈ ਕੁਦਰਤੀ ਤਰੀਕੇ ਵਰਤੋ ਇਹਨਾਂ ਕਦਮਾਂ ਦੀ ਪਾਲਣਾ ਕਰਕੇ ਤੁਸੀਂ ਸਫਲ ਬਾਗਬਾਨੀ ਸ਼ੁਰੂ ਕਰ ਸਕਦੇ ਹੋ